ਮੈਂ ਬਚਪਨ ਵਿੱਚ ਸੋਚਿਆ ਸੀ ਕਿ ਮੈਂ ਵਕੀਲ ਬਣਾਂਗੀ ਅਤੇ ਮੇਰੇ ਮਾਤਾ ਪਿਤਾ ਦਾ ਵੀ ਇਹੀ ਸੁਪਨਾ ਸੀ ਅਤੇ ਮੇਰੇ ਪਿਤਾ ਜੀ ਵਕੀਲ ਬਣਨਾ ਚਾਹੁੰਦੇ ਸਨ ਪਰ ਹਾਲਾਤਾਂ ਕਾਰਨ ਉਹਨਾਂ ਦੀ ਪੜ੍ਹਾਈ ਨਹੀਂ ਹੋ ਸਕੀ ਜਿਸ ਕਰਕੇ ਉਹ ਚਾਹੁੰਦੇ ਸਨ ਕਿ ਮੈਂ ਵਕੀਲ ਬਣਾ ਅਤੇ ਉਹਨਾਂ ਦਾ ਸੁਪਨਾ ਪੂਰਾ ਕਰਾਂ ਅਤੇ ਜਦੋਂ ਮੈਂ ਪੜ੍ਹ ਰਹੀ ਸੀ ਤਾਂ ਜਦੋਂ ਮੈਂ ਗਿਆਰਵੀਂ ਜਮਾਤ ਵਿੱਚ ਹੋਈ ਤਾਂ ਸਾਡੇ ਘਰ ਦੇ ਹਾਲਾਤ ਕੁਛ ਐਵੇਂ ਦੇ ਹੋ ਗਏ ਕਿ ਅਚਾਨਕ ਹੀ ਮੇਰੇ ਮਾਤਾ ਜੀ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਕਿ ਮੇਰੀ ਪੜ੍ਹਾਈ ਛੁੱਟ ਗਈ ਉਸ ਤੋਂ ਬਾਅਦ ਮੈਨੂੰ ਬਹੁਤ ਵੱਡਾ ਝਟਕਾ ਲੱਗਾ ਕਿਉਂਕਿ ਮੈਂ ਪੜ੍ਹਨਾ ਚਾਹੁੰਦੀ ਸੀ ਪਰ ਸਾਡੇ ਘਰ ਦੇ ਹਾਲਾਤ ਐਵੇਂ ਦੇ ਨਹੀਂ ਸਨ ਕਿ ਮੈਨੂੰ ਅੱਗੇ ਪੜ੍ਹਾ ਸਕੇ ਉਸ ਤੋਂ ਬਾਅਦ ਫਿਰ ਮੈਂ ਸਟਿਚਿੰਗ ਦਾ ਕੰਮ ਸ਼ੁਰੂ ਕੀਤਾ ਪਹਿਲਾਂ ਮੈਂ ਡੇਢ ਸਾਲ ਲਗਾ ਕੇ ਸਟਿਚਿੰਗ ਦਾ ਕੰਮ ਸਿੱਖਿਆ ਅਤੇ ਉਸ ਤੋਂ ਬਾਅਦ ਮੈਂ ਘਰ ਵਿੱਚ ਹੀ ਕੰਮ ਕਰਦੀ ਸੀ ਉਸ ਤੋਂ ਬਾਅਦ ਮੈਂ ਬਿਊਟੀ ਪਾਰਲਰ ਦਾ ਕੰਮ ਸਿੱਖਿਆ ਅਤੇ ਇਹ ਦੋ ਕੰਮ ਮੈਂ ਕੀਤੇ ਪਰ ਮੈਂ ਕਰਨਾ ਕੁਛ ਹੋਰ ਚਾਹੁੰਦੀ ਸੀ ਜੋ ਕਿ ਮੈਂ ਵਕੀਲ ਬਣਨਾ ਚਾਹੁੰਦੀ ਸੀ ਪਰ ਉਹ ਸੁਪਨਾ ਮੇਰਾ ਪੂਰਾ ਨਹੀਂ ਹੋਇਆ ਅਤੇ ਮੈਨੂੰ ਸਟਿਚਿੰਗ ਅਤੇ ਬਿਊਟੀ ਪਾਰਲਰ ਦਾ ਕੰਮ ਕਰਨਾ ਪਿਆ